ਹਾਂਜੀ ਸਤਿ ਸ਼੍ਰੀ ਅਕਾਲ ਭਾਅ ਜੀ ਭਾਅ ਜੀ ਮੈਂ ਨਾ ਹੁਣੀ ਸ਼ਿਫਟ ਹੋਇਆ ਕਪੂਰਥਲਾ ਰੋਪੜ ਤੋਂ ਅਤੇ ਉਰੇ ਕੋਈ ਮੈਂ ਹੁਣ ਨਵਾਂ ਸੀਗਾ ਤਾਂ ਮੈਨੂੰ ਇਸ ਜਗ੍ਹਾ ਦੇ ਬਾਰੇ ਜੋ ਨੋਲੇਜ ਹੈ ਨਹੀਂ ਚੰਗੀ ਤਰ੍ਹਾਂ ਤਾਂ ਮੈਂ ਤੁਹਾਡਾ ਨੰਬਰ ਦਿੱਖ ਗਿਆ ਨਾ ਗੂਗਲ 'ਤੇ ਸਰਚ ਕਰ ਰਿਹਾ ਸੀ ਤਾਂ ਮੈਂ ਕਿਹਾ ਚੱਲ ਤੁਹਾਤੋਂ ਕੋਈ ਸਜੈਸ਼ਨ ਲੈ ਲਵਾਂ ਕੋਈ ਵਧੀਆ ਰੈਸਟੋਰੈਂਟਸ ਵਗੈਰਾ ਕਪੂਰਥਲਾ ਦੇ ਵਿੱਚ ਕੋਈ ਹੈ ਕਿੱਥੇ ਹੈ ਕੋਈ ਹਾਂਜੀ ਠੀਕ ਹੈ ਜੀ ਮੈਂ ਤਾਂ ਫਿਰ ਦੇਖੋ ਟੀਪੀਕਲ ਪੰਜਾਬੀ ਹਾਂ ਮੈਨੂੰ ਤਾਂ ਪਨੀਰ ਪਨੂਰ ਵਾਲੀ ਸਬਜ਼ੀਆਂ ਜਾਂ ਫਿਰ ਆਪਣਾ ਛੋਲੇ ਬਸ ਤੜਕੇ ਵਾਲੀ ਸਬਜ਼ੀਆਂ ਮੈਨੂੰ ਵਧੀਆ ਲੱਗਦੀਆਂ ਬਜਟ ਸਰ ਤੁਸੀਂ ਲਗਾ ਲਓ ਕਿ ਵਨ ਪਰਸਨ ਦਾ ਲਗਾ ਕੇ ਚੱਲੋ ਸਰ ਤੁਸੀਂ ਕਿ ਵੰਨ ਥਾਉਂਸੰਡ ਇੱਕ ਹਜ਼ਾਰ ਤੱਕ ਮੈਂ ਅਰਾਮ ਨਾਲ ਲਗਾ ਸਕਦਾ ਬਾਕੀ ਸਰ ਮੈਂ ਅਸੀਂ ਤੁਸੀਂ ਲਗਾ ਲਉ ਵੀ ਚਾਰ ਮੈਂਬਰ ਹਾਂ ਜੀ ਫੈਮਿਲੀ ਦੇ ਵਿੱਚ ਹਾਂਜੀ ਹਾਂਜੀ ਫੈਮਿਲੀ ਵਾਲਾ ਹੋਵੇ ਮਤਲਬ ਐਵੇਂ ਲੋਕਲ ਦਾ ਐਵੇਂ ਇਹ ਵੀ ਨਾ ਹੋਵੇ ਕਿ ਬੈਠਣ ਨੂੰ ਸ਼ੀ ਜਗ੍ਹਾ ਵਧੀਆ ਜਗ੍ਹਾ ਹੋਵੇ ਹਾਂਜੀ ਹਾਂਜੀ ਹਾਂਜੀ ਹਾਂਜੀ ਵੈਜੀਟੇਰੀਆਨ ਜੀ ਵੈਜੀਟੇਰੀਆਨ ਹਾਂਜੀ ਹਾਂਜੀ ਪਿਓਰ ਜੀ ਪਿਓਰ ਅੱਛਾ ਜੀ ਨਹੀਂ ਸਰ ਐਕਚੁਲੀ ਮੈਨੂੰ ਸਰ ਡਰਿੰਕ ਡਰੂੰਕ ਵਾਲੇ ਨਹੀਂ ਚਾਹੀਦੇ ਦੇਖੋ ਜੀ ਮੈਨੂੰ ਉਹ ਸਜੈਸਟ ਕਰੋ ਜਿਹਦੇ ਵਿੱਚ ਮੇਨ ਸਿੰਪਲ ਰੋਟੀ ਹੋਵੇ ਵੈਸ਼ਨੂੰ ਹੋਵੇ ਕੰਮ ਅਤੇ ਡਰਿੰਕ ਵਾਲਾ ਕੰਮ ਨਾ ਹੋਵੇ ਉੱਥੇ ਕਿਉਂਕਿ ਮੇਰੇ ਨਾਲ ਮੇਰੇ ਫਾਦਰ ਸਾਹਿਬ ਹੋਣਗੇ ਅਤੇ ਉਹਨਾਂ ਨੂੰ ਵਧੀਆ ਨਹੀਂ ਲੱਗਦੇ ਇਹ ਚੀਜ਼ਾਂ ਸਾਹਮਣੇ ਠੀਕ ਅੱਛਾ ਜੀ ਅੱਛਾ ਜੀ ਠੀਕ ਹੈ ਅੱਛਾ ਕਿਹੜਾ ਜੀ ਚਿੜੀ ਦਾ ਢਾਬਾ ਅੱਛਾ ਚਿੜੀ ਦਾ ਢਾਬਾ ਜੀ ਅੱਛਾ ਅੱਛਾ ਕੋਈ ਇਹੋ ਜਿਹਾ ਰੈਸਟੋਰੈਂਟ ਵੀ ਹੈ ਜਿੱਥੇ ਜੇ ਸਰ ਜਿੱਥੇ ਹੋਰ ਵਧੀਆ ਐਮਬੀਐਂਸ ਤੋਂ ਇਲਾਵਾ ਹੋਰ ਗੇਮਸ ਵਗੈਰਾ ਵੀ ਹੋਣ ਬੰਦਾ ਟਾਈਮ ਸਪੈਂਡ ਕਰ ਲਏ ਅੱਛਾ ਅੱਛਾ ਓਕੇ ਓਕੇ ਓਕੇ ਓਕੇ ਠੀਕ ਹੈ ਜੀ ਹਾਂਜੀ ਓਕੇ ਓਕੇ ਓਕੇ ਚਲੋ ਠੀਕ ਠੀਕ ਚਲੋ ਠੀਕ ਹੈ ਸਰ ਤੁਹਾਡੇ ਸਜੈਸ਼ਨ ਬਾਕੀ ਡਿਸਾਈਡ ਕਰਕੇ ਦੇਖਦਾ ਮੈਂ ਫੈਮਲੀ ਨਾਲ ਡਿਸਾਈਡ ਕਰਦਾ ਫਿਰ ਦੱਸਦਾ ਜੀ ਤੁਹਾਨੂੰ ਵੀ ਕਿਹੜੇ ਵਧੀਆ ਲੱਗੇ ਓਕੇ ਥੈਂਕ ਯੂ ਸਰ ਥੈਂਕ ਯੂ ਸ਼ੁਕਰੀਆ ਜੀ